ਹੈਲੋ ਹਾਂਜੀ ਸਾਈਨ ਟਰਾਂਸਪੋਰਟ ਤੋਂ ਗੱਲ ਕਰ ਰਹੇ ਹੋ ਹਾਂਜੀ ਸਰ ਸਰ ਮੈਂ ਸਤਪਿੰਦਰ ਸਿੰਘ ਬੋਲ ਰਿਹਾ ਜੀ ਕੱਲ ਮੈਂ ਇੱਕ ਕੈਬ ਬੁੱਕ ਕੀਤੀ ਸੀਗੀ ਨਾ ਤੁਹਾਡੇ ਟਰਾਂਸਪੋਰਟ ਏਜੰਸੀ ਤੋਂ ਹਾਂਜੀ ਸਰ ਮੈਂ ਥੋੜ੍ਹਾ ਜਿਹਾ ਫੀਡਬੈਕ ਤੁਹਾਨੂੰ ਦੇਣਾ ਸੀਗਾ ਕਿ ਮੇਰਾ ਐਕਸਪੀਰੀਅੰਸ ਬਹੁਤ ਹੀ ਮਾੜਾ ਰਿਹਾ ਸਰ ਬਹੁਤ ਹੀ ਮਾੜਾ ਪਹਿਲੀ ਗੱਲ ਤਾਂ ਜੀ ਕੋਈ ਹੈ ਨਾ ਕੋਵਿਡ ਰਿਸ ਰਿਸਟ੍ਰਿਕਸ਼ਨ ਇਹਨਾਂ ਨੇ ਫੋਲੋ ਨਹੀਂ ਕੀਤੀਆਂ ਹੈ ਨਾ ਦੂਜੀ ਗੱਲ ਕਾਰ ਅੰਦਰੋਂ ਇੰਨੀ ਜ਼ਿਆਦਾ ਗੰਦੀ ਸੀਗੀ ਇੰਨੀ ਜ਼ਿਆਦਾ ਗੰਦੀ ਸੀਗੀ ਮੈਨੂੰ ਬੈਠਦੇ ਨੂੰ ਵੀ ਖੁਦ ਨੂੰ ਖੁਦ ਨੂੰ ਵੀ ਫੀਲ ਹੋ ਰਿਹਾ ਸੀਗਾ ਮੈਂ ਜਸਟ ਇੱਕ ਮਜ਼ਬੂਰੀ ਨੂੰ ਇਹ ਕੈਬ ਕੈਬ 'ਚ ਬੈਠ ਕੇ ਆਇਆ ਅਦਰਵਾਈਜ਼ ਜੋ ਕਾਰ ਦੀ ਅੰਦਰੋਂ ਕੰਡੀਸ਼ਨ ਸੀਗੀ ਮੈਂ ਮੈਂ ਬਿਲਕੁਲ ਵੀ ਸੈਟਿਸਫਾਈ ਨਹੀਂ ਸੀਗਾ ਅਤੇ ਮੇਰੀ ਇਹ ਰਿਕੁਐਸਟ ਹੈ ਜੀ ਜਦੋਂ ਵੀ ਮੈਂ ਕੋਈ ਕੈਬ ਬੁੱਕ ਕਰਾਂ ਸਤਪਿੰਦਰ ਸਿੰਘ ਮੇਰਾ ਨਾਮ ਆ ਤੁਸੀਂ ਵੈਸੇ ਜਾਣਦੇ ਹੀ ਹੋਊਗੇ ਵੈਸੇ ਵੀ ਕਰਦਾ ਤਾਂ ਮੈਨੂੰ ਇੱਕ ਸਾਫ਼ ਸੁਥਰੀ ਕੈਬ ਜ਼ਰੂਰ ਭੇਜੀ ਭੇਜਣ ਦੀ ਕਿਰਪਾਲਤਾ ਕਰਨੀ ਜੀ ਅਤੇ ਬਾਕੀ ਡਰਾਈਵਰ ਸੀਗੇ ਉਹ ਅੱਛੇ ਸੀਗੇ ਉਹ ਵੈਲ ਮੈਨ ਵੈਲ ਬਿਹੇਵ ਕਰ ਰਹੇ ਸੀਗੇ ਥੈਂਕ ਯੂ ਥੈਂਕ ਯੂ ਵੈਰੀ ਮੱਚ